ਗਾਉਣ ਵਿੱਚ ਮੈਨੂੰ ਸੰਗੀਤ ਦੀ ਦੀ ਸਭ ਤੋਂ ਪਸੰਦੀਦਾ ਸ਼ੈਲੀ ਮੇਰੀ ਸ ਦੁੱਖ ਭਰੇ ਸੌਂਗ ਹੈ ਕਿਉਂਕਿ ਮੈਨੂੰ ਉਹ ਬਹੁਤ ਜ਼ਿਆਦਾ ਮੈਨੂੰ ਪਸੰਦ ਹਨ ਅਤੇ ਉਹ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਦਿੰਦੇ ਹਨ ਦੁਖ ਦੁਖੀ ਗੀਤ ਸੈਡ ਸੌਂਗ ਮੇਰੇ ਬਹੁਤ ਜ਼ਿਆਦਾ ਫੇਵਰਿਟ ਸੌਂਗ ਹਨ ਉਹ ਮੈਨੂੰ ਮੇਰੇ ਦਿਲ ਦੇ ਅੰਦਰ ਤੱਕ ਮੇਰੀਆਂ ਗੱਲਾਂ ਜੋ ਮੇਰੇ ਦਿਲ 'ਚ ਚੱਲ ਰਹੀਆਂ ਹੁੰਦੀਆਂ ਹੈ ਉਹ ਮੈਨੂੰ ਆਪਣੇ ਨਾਲ ਇੱਕ ਤਰ੍ਹਾਂ ਦੀਆਂ ਆਏਂ ਅਟੈਚ ਹੁੰਦੀਆਂ ਹਨ ਅਤੇ ਜਿਸ ਕਾਰਨ ਮੈਨੂੰ ਉਹ ਬਹੁਤ ਜ਼ਿਆਦਾ ਮੇਰੇ ਦਿਲ ਨੂੰ ਸਕੂਨ ਦਿੰਦਾ ਹੈ ਅਤੇ ਮੈਨੂੰ ਗਾਉਣ ਸ਼ੈਲੀ ਵਿੱਚ ਪਸੰਦੀਤਾ ਦੀ ਉਹ ਮੈਨੂੰ ਇਸ ਲਈ ਕਿਉਂ ਮੈਨੂੰ ਇਸ ਲਈ ਪਸੰਦ ਹੈ ਕਿਉਂਕਿ ਉਹ ਮੇਰੀ ਫੀਲਿੰਗਸ ਨੂੰ ਕਰ ਦਿੰਦਾ ਹੈ ਜੋ ਮੇਰੇ ਦਿਲ ਵਿੱਚ ਚੱਲ ਰਿਹਾ ਹੈ ਜੋ ਮੇਰੇ ਦਿਮਾਗ 'ਚ ਵਿੱਚ ਚੱਲ ਰਿਹਾ ਹੈ ਉਹੀ ਉਹ ਚੀਜ਼ਾਂ ਟੂਨ ਵਿੱਚ ਗਾ ਕੇ ਉਹਨਾਂ ਨੇ ਸੁਣਾਈਆਂ ਹੁੰਦੀਆਂ ਹਨ ਅਤੇ ਉਹ ਮੈਨੂੰ ਬਹੁਤ ਜ਼ਿਆਦਾ ਸਕੂਨ ਦਿੰਦੀਆਂ ਹਨ ਸੁਣ ਸੁਣ ਕੇ ਉਹ ਮੈਂ ਇਸੀ ਕਾਰਨ ਮੈਂ ਉਹਨੂੰ ਬਹੁਤ ਜ਼ਿਆਦਾ ਵਾਰ ਵੀ ਸੁਣਦਾ ਹਾਂ ਕਈ ਵਾਰ ਤਾਂ ਸੁਣਦਾ ਹੀ ਰਹਿੰਦਾ ਹਾਂ ਬਾਰ ਬਾਰ ਸੁਣਦਾ ਹਾਂ ਕਿਉਂਕਿ ਉਹ ਮੇਰੇ ਮੇਰਾ ਦੁੱਖ ਨੂੰ ਹਮੇਸ਼ਾ ਘੱਟ ਕਰਦੇ ਹਨ ਅਤੇ ਮੇਰੇ ਉਹ ਨੇਚਰ ਅਤੇ ਮੇਰੇ ਵਿਵਹਾਰ ਦੇ ਨਾਲ ਨਿਰਭਰ ਕਰਦੇ ਹਨ ਕਿਉਕਿ ਮੈਨੂੰ ਹਮੇਸ਼ਾ ਦੁਖੀ ਜੋ ਵੀ ਮੈਨੂੰ ਕੋਈ ਕਦੇ ਦੁੱਖ ਤਕਲੀਫ ਹੁੰਦੀ ਹੈ ਤਾਂ ਮੈਂ ਉਹ ਗਾਣੇ ਸੁਣ ਕੇ ਆਪਣੇ ਦੁੱਖਾਂ ਨੂੰ ਦੂਰ ਕਰਦਾ ਹਾਂ ਤਕਲੀਫ ਆਪਣੇ ਸਾਰੇ ਆਪਣੇ ਦੁੱਖ ਨੂੰ ਇਸ ਕਾਰਨ ਹੀ ਮੈਂ ਦੂਰ ਕਰ ਲੈਂਦਾ ਹਾਂ ਸੁਣ ਕੇ ਆਪਣੇ ਆਪਣੇ ਸਾਰੇ ਆਪਣੇ ਦੁੱਖ ਨੂੰ ਭੁੱਲ ਜਾਂਦਾ ਹਾਂ